ਆਧੁਨਿਕ ਸੰਸਾਰ ਵਿੱਚ ਲੋਕਾਂ ਲਈ ਤਕਨੀਕੀ ਹੁਨਰ ਬਹੁਤ ਆ ਗਏ ਹਨ ਅੱਜ ਕੱਲ ਲੋਕ ਵੀਡੀਓ ਕਾਲ 'ਤੇ ਗੱਲਾਂ ਕਰਦੇ ਹਨ ਕਾਨਫਰੰਸ ਤੇ ਗੱਲਾਂ ਕਰਦੇ ਹਨ ਇਹ ਲੋਕ ਪਹਿਲਾਂ ਫੋਨ ਨਹੀਂ ਹੁੰਦੇ ਸੀ ਜਦੋਂ ਐਂਡਰਾਇਡ ਫੋਨ ਨਹੀਂ ਹੁੰਦੇ ਸੀ ਤਾਂ ਤਾਰਾਂ ਵਾਲੇ ਫੋਨ ਹੁੰਦੇ ਸੀ ਉਹਨਾਂ ਕਰਕੇ ਲੋਕ ਇੱਕ ਦੂਜੇ ਨੂੰ ਨਹੀਂ ਦੇਖ ਸਕਦੇ ਸੀ ਪਰ ਆਪਣੇ ਵਿਚਾਰ ਆਪਣੀ ਗੱਲਾਂ ਸਾਂਝੀਆ ਕਰ ਲੈਂਦੇ ਸੀ ਅੱਜ ਕੱਲ ਲੋਕ ਫੇਸਬੁਕ ਯੂਟਿਊਬ ਆ ਗਿਆ ਹੈ ਲੋਕਾਂ ਨੇ ਬਹੁਤ ਪੈਸੇ ਕਮਾ ਲਏ ਹਨ ਯੂਟਿਊਬ ਰਾਹੀ ਆਪਣੇ ਚੈਨਲ ਬਣਾ ਕੇ ਬਹੁਤ ਸੀ ਬਲੋਗ ਵੀਡੀਓ ਬਣਾ ਕੇ ਆਪਣੇ ਪੈਹੇ ਕਮਾਂਦੇ ਹਨ ਅੱਜ ਕੱਲ ਯੂਟਿਊਬ ਆ ਗਿਆ ਹੈ ਲੋਕਾਂ ਨੇ ਯੂਟਿਊਬ ਤੇ ਬਹੁਤ ਸਾਰੀ ਵੀਡੀਓ ਬਣਾ ਕੇ ਬਹੁਤ ਪੈਸੇ ਕਮਾ ਲਏ ਕੀ ਇੰਸਟਾਗਰਾਮ ਤੇ ਲੋਕ ਵੀਡੀਓ ਬਣਾ ਕੇ ਪੈਸੇ ਛਾਪਦੇ ਹਨ ਮਨੋਰੰਜਨ ਵਧੀਆ ਹੋ ਜਾਂਦਾ ਹੈ ਫੇਸਬੁੱਕ ਤੇ ਲੋਕਾਂ ਨੂੰ ਬਹੁਤ ਸੀ ਖਬਰਾਂ ਵੇਖਣ ਨੂੰ ਮਿਲ ਜਾਂਦੀਆਂ ਹਨ ਅੱਜ ਕੱਲ ਬਹੁਤ ਸੇ ਹਾਦਸੇ ਹੋ ਰਹੇ ਜਿਨਾਂ ਰਾਹੀਂ ਖਬਰਾਂ ਸਾਨੂੰ ਫੇਸਬੁਕ ਰਾਹੀਂ ਮਿਲ ਜਾਂਦੀਆਂ ਹਨ ਹੋਰ ਬਹੁਤ ਸਾਰੇ ਵਿਆਹ ਸ਼ਾਦੀਆਂ ਦੀਆਂ ਵੀਡੀਓ ਲੋਕ ਸਾਂਝੇ ਕਰਕੇ ਆਪਣੀ ਖੁਸ਼ੀਆਂ ਸਾਂਝੀਆਂ ਕਰਦੇ ਹਨ ਔਰ ਬਹੁਤ ਸਾਰੀ ਵੀਡੀਓ ਸਾਂਝੀਆਂ ਕਰਦੇ ਹਨ ਪਹਿਲਾ ਲੋਕ ਕਾਨਫਰੰਸ ਨਹੀਂ ਹੁੰਦੀ ਸੀ ਤਾਂ ਲੋਕ ਇੱਕ ਦੂਜੇ ਨਾਲ ਹੀ ਵੈਸੇ ਹੀ ਗੱਲਾਂ ਕਰ ਲੈਂਦੇ ਸੀ ਅੱਜ ਕੱਲ ਕੋਂਨਫਰੰਸ ਤੇ ਲਾ ਕੇ ਲੋਕ ਇੱਕ ਦੂਜੇ ਨਾਲ ਬਹੁਤ ਗੱਲਾਂ ਕਰ ਸਕਦੇ ਹਨ ਇੱਕ ਇੱਕ ਦੋ ਹੀ ਨਹੀਂ ਬਿਲਕੁਲ ਦਸ ਪੰਦਰਾਂ ਜਣੇ ਇੱਕ ਦੂਜੇ ਨਾਲ ਗੱਲ ਕਰ ਸਕਦੇ ਹਨ ਕੋਂਨਫਰੰਸ ਬਹੁਤ ਵਧੀਆ ਚੀਜ਼ ਹੈ ਕੋਂਨਫਰੰਸ ਫੋਨ ਵੀ ਬਹੁਤ ਵਧੀਆ ਹੈ ਕੋਂਨਫਰੰਸ ਫੋਨ ਤੇ ਲੋਕ ਇੱਕ ਦੂਜੇ ਨਾਲ ਗੱਲਾਂ ਕਰਕੇ ਇੱਕ ਦੂਜੇ ਦੇ ਵਿਚਾਰ ਸਾਂਝੇ ਕਰਕੇ ਖੁਸ਼ੀਆਂ ਦੁੱਖ ਵੰਡ ਸਕਦੇ ਹਨ ਅੱਜ ਕੱਲ ਫੋਨ ਨੇ ਆਧੁਨਿਕ ਸੰਸਾਰ ਵਿੱਚ ਬਹੁਤ ਤਰੱਕੀ ਕਰ ਲਈ ਆ ਇਹਨਾਂ ਕਰਕੇ ਸਾਨੂੰ ਬਹੁਤ ਕੁਝ ਸਿੱਖਣ ਲਈ ਮਿਲ ਗਿਆ ਹੈ ਅੱਜ ਕੱਲ ਫੋਨਾਂ ਨੇ ਬਹੁਤ ਕੁਝ ਲੋਕਾਂ ਨੂੰ ਸਿਖਾ ਦਿੱਤਾ ਇਹ ਬਹੁਤ ਫਾਇਦੇਮੰਦ ਹਨ ਇਹਨਾਂ ਕਰਕੇ ਉਖਾਈਆਂ ਕੱਟ ਗਈਆਂ ਹਨ ਬਹੁਤ ਸਾਰੇ ਵਾਧੇ ਹੋ ਚੁੱਕੇ ਹਨ